ਮੈਂ ਆਪਣੇ ਕੰਮ ਵਿੱਚ ਯਥਾਰਥਵਾਦ ਅਤੇ ਅਮੂਰਤਤਾ ਨੂੰ ਦੋਵਾਂ ਨੂੰ ਬੈਲੈਂਸ ਕਰਕੇ ਚੱਲਦਾ ਜੋ ਵੀ ਇਨ ਪ੍ਰੇਜੈਂਟ ਮੇਰੇ ਨਾਲ ਕੁਛ ਹੋ ਰਿਹਾ ਮੈਂ ਸਾਰਾ ਮੇਰਾ ਪੂਰਾ ਫੋਕਸ ਪ੍ਰੋਪਰ ਕੋਸਨਟ੍ਰੇਸ਼ਨ ਮੇਰੀ ਮੇਰੇ ਪ੍ਰੈਜੈਂਟ 'ਤੇ ਹੁੰਦੀ ਹੈ ਯਾਨੀ ਕਿ ਯਥਾਰਥਵਾਦ 'ਤੇ ਮੈਂ ਜ਼ਿਆਦਾ ਬਿਲੀਵ ਕਰਦਾ ਬਟ ਅਗਰ ਮੈਂ ਕੋਈ ਵੀ ਸਟੈਪ ਜਾਂ ਕੋਈ ਵੀ ਪਲੈਨ ਸੋਚਦਾਂ ਅਮੂਰਤਤਾ ਆਪਣੇ ਮਾਇੰਡ ਵਿੱਚ ਕ੍ਰੀਏਟ ਕਰਦਾ ਤਾਂ ਉਹਦੇ 'ਤੇ ਫੋਕਸ ਮੈਂ ਅੱਜ ਹੀ ਕਰੂੰਗਾ ਮੈਂ ਆਉਣ ਵਾਲੇ ਸਮੇਂ 'ਤੇ ਨਹੀਂ ਛੱਡੂਗਾ ਉਹਨੂੰ ਫੋਰ ਐਗਜੈਂਪਲ ਮੈਂ ਅੱਜ ਸਵੇਰੇ ਸੋਚ ਰਿਹਾ ਸੀਗਾ ਕਿ ਮੈਂ ਆਪਣਾ ਇੱਕ ਇੰਸਟੀਚਿਊਟ ਤਿਆਰ ਕਰੂੰਗਾ ਬਟ ਉਹਦੇ ਲਈ ਪਲੈਨਿੰਗ ਮੈਂ ਅੱਜ ਅੱਜ ਤੋਂ ਹੀ ਸ਼ੁਰੂ ਕਰਤੀ ਇੰਨ ਪ੍ਰੈਜੈਂਟ ਹੀ ਸ਼ੁਰੂ ਕਰਤੀ ਸੋਚਿਆ ਮੈਂ ਇੰਨ ਫਿਊਚਰ ਦਾ ਬਟ ਕੰਮ ਉਹਦੇ ਲਈ ਮੈਂ ਅੱਜ ਸ਼ੁਰੂ ਕੀਤਾ ਉਹਦੇ ਲਈ ਮੈਂ ਆਪਣੇ ਬ੍ਰੋਛਰਸ਼ ਤਿਆਰ ਕਰਨੇ ਸ਼ੁਰੂ ਕੀਤੇ ਸਟੂਡੈਂਟਸ ਵਿੱਚ ਪ ਪ ਪ੍ਰਚਾਰ ਕੀਤਾ ਅੱਜ ਹੀ ਸਾਰਾ ਕੁਛ ਅੱਜ ਕੀਤਾ ਸੋ ਇਸ ਤਰੀਕੇ ਨਾਲ ਮੈਂ ਆਪਣੇ ਕੰਮ ਵਿੱਚ ਯਥਾਰਥਵਾਦ ਅਤੇ ਅਮੂਰਤਤਾ ਨੂੰ ਦੋਵਾਂ ਨੂੰ ਬੈਲੈਂਸ ਕਰਕੇ ਚੱਲਦਾ ਕਿਉਂਕਿ ਜਿਹੜਾ ਬੰਦਾ ਸਿਰਫ ਅਮੂਰਤਤਾ ਹੀ ਕੰਮ ਕਰਦਾ ਸਿਰਫ ਸੋਚਦਾ ਹੀ ਸੋਚਦਾ ਉਹ ਇਨ ਪ੍ਰਜੈਂਟ ਕੁਛ ਨਹੀਂ ਕਰਦਾ ਉਹ ਪ੍ਰੋਪਰ ਆਪਣੇ ਪਲੈਨਸ ਨੂੰ ਅਮਲ ਨਹੀਂ ਕਰ ਸਕਦਾ ਸੋ ਅਕੋਰਡਿੰਗ ਟੂ ਮੀ ਯਥਾਰਥ ਯਥਾਰਥਤਾ ਅਤੇ ਅਮੂਰਤਤਾ ਨੂੰ ਦੋਵਾਂ ਨੂੰ ਇੰਪਲੀਮੇਂਟ ਕਰਨਾ ਲਾਈਫ ਵਿੱਚ ਬਹੁਤ ਜ਼ਰੂਰੀ ਆ